ਪਿੰਡ ਵਿੱਚ ਵਿਅਕਤੀਆਂ ਨੂੰ ਸੱਪ ਦਾ ਕੱਟਣਾ ਆਮ ਗੱਲ ਹੈ ਕਿਉਂਕਿ ਖੇਤਾਂ ਵਿੱਚ ਪਾਣੀ ਆਦਿ ਲਗਾਉਂਦੇ ਸਮੇਂ ਵੀ ਸੱਪ ਕਈ ਵਾਰ ਕੱਟ ਲੈਂਦੇ ਹਨ ਇਸ ਲਈ ਜੇਕਰ ਕਿਸੇ ਵਿਅਕਤੀ ਨੂੰ ਸੱਪ ਨੇ ਕੱਟ ਲਿਆ ਤਾਂ ਉਹ ਸਭ ਤੋਂ ਪਹਿਲਾਂ ਉਸਨੂੰ ਹੌਂਸਲਾ ਦੇਣਾ ਚਾਹੀਦਾ ਹੈ ਕਿਉਂਕਿ ਉਸ ਨੂੰ ਹੌਂਸਲਾ ਦੇਣ ਦੇ ਨਾਲ ਉਸ ਦੀ ਵਿੱਲ ਪਾਵਰ ਵਧਦੀ ਹੈ ਕਿ ਕੁਝ ਨਹੀਂ ਹੋਵੇਗਾ ਅਤੇ ਸਭ ਤੋਂ ਪਹਿਲਾਂ ਉਸ ਆਦਮੀ ਦੇ ਕੋਲ ਜਾ ਕੇ ਉਸਦੇ ਸਰੀਰ ਵਿੱਚ ਜਿਹੜਾ ਜਹਿਰ ਫੈਲ ਰਿਹਾ ਉਹਨੂੰ ਰੋਕਣ ਲਈ ਉਸ ਥਾਂ ਨੂੰ ਬੰਨ੍ਹ ਦੇਣਾ ਚਾਹੀਦਾ ਹੈ ਉਹੀ ਜਹਿਰ ਹੌਲੀ ਹੌਲੀ ਖੂਨ ਰਾਹੀਂ ਕਈ ਵਾਰ ਸਾਰੇ ਸਰੀਰ ਵਿੱਚ ਫੈਲ ਜਾਂਦਾ ਹੈ ਆਮ ਤੌਰ 'ਤੇ ਸੱਪ ਦੇ ਜਹਿਰ ਨੂੰ ਪੂਰੇ ਸਰੀਰ ਵਿੱਚ ਫੈਲਣ ਤੋਂ ਤਿੰਨ ਤੋਂ ਚਾਰ ਘੰਟੇ ਲੱਗ ਜਾਂਦੇ ਹਨ ਅਤੇ ਇਸ ਲਈ ਇਹ ਉਹ ਸਮਾਂ ਹੈ ਜਿਸ ਵਿੱਚ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ ਅਤੇ ਸਭ ਤੋਂ ਪਹਿਲਾਂ ਮਰੀਜ਼ ਕੋਲ ਜਾ ਕੇ ਦੇਖਣਾ ਚਾਹੀਦਾ ਕਿ ਜੇ ਉਹ ਆਸ ਪਾਸ ਕਿਤੇ ਸੱਪ ਹੈ ਤਾਂ ਉਸ ਨੂੰ ਡੰਡੇ ਆਦਿਕ ਨਾਲ ਭਜਾ ਦੇਣਾ ਚਾਹੀਦਾ ਹੈ ਅਤੇ ਨੇੜੇ ਦੇ ਹਸਪਤਾਲ ਦਾ ਪਤਾ ਲਗਾਓ ਲਗਾ ਲੈਣਾ ਚਾਹੀਦਾ ਹੈ ਜਾਂ ਐਂਬੂਲੈਂਸ ਨੂੰ ਫੋਨ ਕਰ ਦੇਣਾ ਚਾਹੀਦਾ ਹੈ ਉਸ ਤੋਂ ਇਲਾਵਾ ਜਿਸ ਕੋਈ ਸਰੀਰ ਦੇ ਕੱਟੇ ਹੋਏ ਹਿੱਸੇ ਦੇ ਨੇੜੇ ਜਾਂ ਸਰੀਰ ਵਿੱਚ ਕੋਈ ਹੋਰ ਚੀਜ਼ਾਂ ਜਿਵੇਂ ਕਿ ਗਹਿਣੇ ਆਦਿਕ ਮੁੰਦਰੀਆਂ ਚੈਨੀ ਬ੍ਰੇਸਲੈੱਟ ਚੂੜੀ ਆਦਿ ਹੈ ਤਾਂ ਉਸਨੂੰ ਉਤਾਰ ਲੈਣਾ ਚਾਹੀਦਾ ਹੈ ਕਿਉਂਕਿ ਸੋਜ ਹੋਣ 'ਤੇ ਇਹ ਚੀਜ਼ਾਂ ਨੁਕਸਾਨ ਪਹੁੰਚਾ ਦਿੰਦੀਆਂ ਹਨ ਪੀੜਤ ਨੂੰ ਭਰੋਸਾ ਦਵਾਉਣਾ ਚਾਹੀਦਾ ਹੈ ਕਿ ਉਸ ਨੂੰ ਕੁਝ ਨਹੀਂ ਹੋਵੇਗਾ ਅਤੇ ਤੁਰੰਤ ਕਿਸੇ ਵਾਹਨ ਦੀ ਮਦਦ ਨਾਲ ਉਸ ਨੂੰ ਨਜ਼ਦੀਕੀ ਹਸਪਤਾਲ ਵਿੱਚ ਪਹੁੰਚਾਉਣਾ ਚਾਹੀਦਾ ਹੈ ਕਿਉਂਕਿ ਆਮ ਤੌਰ 'ਤੇ ਸਿਵਲ ਹਸਪਤਾਲ ਵਿੱਚ ਇਸ ਦਾ ਇਲਾਜ ਵੀ ਮੁਫਤ ਵਿੱਚ ਹੁੰਦਾ ਹੈ